ਹਾਂਜੀ ਬਲਵਿੰਦਰ ਜੀ ਸਰਤਾਜ ਟੂਰ ਐਂਡ ਟ੍ਰੈਵਲ ਤੋਂ ਹਾਂਜੀ ਮੈਂ ਪਰਸੋਂ ਨਾ ਇੱਕ ਕੈਬ ਬੁੱਕ ਕੀਤੀ ਸੀਗੀ ਚੰਡੀਗੜ੍ਹ ਏਅਰਪੋਰਟ ਲਈ ਹਾਂਜੀ ਮੁੰਡੇ ਨਾਲ਼ ਗੱਲ ਹੋਈ ਸੀਗੀ ਉਹ ਨਾ ਮੈਂ ਉਹਨੂੰ ਟਾਇਮ ਦਿੱਤਾ ਸੀਗਾ ਸੋਮਵਾਰ ਦਾ ਸਵੇਰੇ ਅੱਠ ਵਜੇ ਦਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਇੱਕ ਤਾਂ ਟਾਈਮ 'ਤੇ ਪਹੁੰਚ ਜਿਓ ਕਿਉਂਕਿ ਮੈਂ ਵਿਦ ਫੈਮਿਲੀ ਜਾਣਾ ਆ ਅਤੇ ਉੱਥੇ ਜਾਣਾ ਮੇਰਾ ਜ਼ਰੂਰੀ ਬਹੁਤ ਹੈ ਅਤੇ ਰਸਤੇ ਵਿੱਚ ਹੋ ਸਕਦਾ ਸਾਨੂੰ ਕਿਤੇ ਰੁੱਕਣਾ ਵੀ ਪੈ ਸਕਦਾ ਆ ਇੱਕ ਸਾਡੇ ਇੱਧਰ ਰਸਤਾ ਬਣਨਾ ਬਣ ਰਿਹਾ ਨਾ ਉਹਦੀ ਡਾਈਵਰਸ਼ਨ ਚੇਂਜ ਕੀਤੀ ਵੀ ਹੈ ਤੁਸੀਂ ਆਉਣ ਤੋਂ ਪਹਿਲਾਂ ਇੱਕ ਵਾਰੀ ਯਾ ਤਾਂ ਪਤਾ ਕਰ ਲਿਓ ਮੈਂ ਲੋਕੇਸ਼ਨ ਤੁਹਾਨੂੰ ਉੱਦਾਂ ਸੈਂਡ ਕਰਦੂਂਗਾ ਲੇਕਿਨ ਤੁਸੀਂ ਇੱਕ ਵਾਰੀ ਪਤਾ ਕਰ ਲਿਓ ਕਿ ਜਿਹੜਾ ਰੋਡ ਉੱਧਰੋਂ ਬੰਦ ਹੈ ਤਾਂ ਉਹਦੀ ਡਾਇਵਰਸ਼ਨ ਕਿੱਧਰ ਨੂੰ ਕੀਤੀ ਵੀ ਹੈ ਤਾਂ ਜੋ ਲੇਟ ਨਾ ਹੋ ਜਾਇਓ ਕਿਤੇ ਐਟ ਏ ਟਾਈਮ ਰਸਤਾ ਲੱਭਦੇ ਲੱਭਦੇ ਠੀਕ ਹੈ ਜੀ ਹਾਂ ਕਿਉਂਕਿ ਮੇਰੀ ਜ਼ਰੂਰੀ ਅਰਜੈਂਟ ਮੀਟਿੰਗ ਹੈ ਅਤੇ ਮੈਨੂੰ ਟਾਇਮ 'ਤੇ ਪਹੁੰਚਣਾ ਆ ਕਿਤੇ ਕਿਤੇ ਲੇਟ ਨਾ ਹੋ ਜਾਈਏ ਰਸਤੇ 'ਤੇ ਡਾਈਵਰਸ਼ਨ ਕਰਕੇ ਠੀਕ ਹੈ ਜੀ ਹਾਂਜੀ ਤੁਸੀਂ ਪਹੁੰਚ ਕੇ ਮੈਨੂੰ ਫ਼ੋਨ ਕਰ ਲਿਓ ਚਾਹੇ ਯਾ ਮੈਸਿਜ ਕਰ ਦਿਓ ਮੈਨੂੰ ਅੱਵਲ ਤਾਂ ਮੈਂ ਲੋਕੇਸ਼ਨ ਭੇਜ ਦੇਣੀ ਹੈ ਇੱਥੇ ਏਰੀਏ ਦੀ ਠੀਕ ਹੈ ਹਾਂ ਬਾਕੀ ਰਸਤੇ 'ਚ ਕਿਆ ਪਤਾ ਹੋ ਸਕਦਾ ਨਿਆਣੇ ਕਈ ਵਾਰ ਹੁੰਦਾ ਹੈ ਰੋਕਣਾ ਪੈ ਜਾਂਦਾ ਕੁਝ ਖਾਣ ਪੀਣ ਲਈ ਤਾਂ ਟਾਇਮ ਨਾਲ ਨਿਕਲਾਂਗੇ ਤਾਂ ਚੰਗਾ ਹੈ ਕਿ ਅਸੀਂ ਟਾਇਮ ਨਾਲ ਪਹੁੰਚ ਜਾਵਾਂਗੇ ਠੀਕ ਹੈ ਜੀ ਹਾਂ ਮੰਡੇ ਸਵੇਰੇ ਅੱਠ ਵਜੇ ਲੋਕੇਸ਼ਨ ਮੈਂ ਤੁਹਾਨੂੰ ਸੈਂਡ ਕਰਦੂਂਗਾ ਠੀਕ ਹੈ ਜੀ ਥੈਂਕ ਯੂ